ਹਾਂਜੀ ਅਸੀਂ ਮੱਧ ਪੀੜ੍ਹੀ ਦਾ ਹਿੱਸਾ ਹਾਂ ਜੋ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਚਾਹੁੰਦੀ ਹੈ ਕਿ ਅਸੀਂ ਅੱਜ ਆਪਣੇ ਵਾਤਾਵਰਨ ਨੂੰ ਬਚਾਈਏ ਅਤੇ ਉਸ ਪਹਿਲਾਂ ਵਾਲੇ ਵਾਤਾਵਰਨ ਵਾਂਗ ਸ਼ੁੱਧ ਅਤੇ ਸਾਫ਼ ਰੱਖੀਏ ਜੋ ਪੁਰਾਣੀ ਪੀੜ੍ਹੀ ਪੁਰਾਣੀ ਪੀੜ੍ਹੀ ਚਾਹੁੰਦੀ ਹੈ ਕਿ ਅਸੀਂ ਪਹਿਲਾਂ ਵਾਂਗ ਹੀ ਮਿੱਟੀ ਦੇ ਭਾਂਡਿਆਂ ਵਿੱਚ ਰੋਟੀ ਖਾਈਏ ਆਪਣੇ ਖਾਣ ਪੀਣ ਨੂੰ ਉੱਦਾਂ ਹੀ ਰੱਖੀਏ ਅਤੇ ਨੌਜਵਾਨ ਪੀੜ੍ਹੀ ਵੀ ਇਹ ਚਾਹੁੰਦੀ ਹੈ ਕਿ ਸਾਡਾ ਜਿਹੜਾ ਵਾਤਾਵਰਨ ਹੈ ਉਹ ਸ਼ੁੱਧ ਰਹੇ ਅਸੀਂ ਪੇੜ ਪੌਦੇ ਲਾਈਏ ਉਸ ਹਵਾ ਨੂੰ ਵੀ ਸ਼ੁੱਧ ਰੱਖੀਏ ਅਤੇ ਖਾਣ ਪੀਣ ਵੀ ਅਸੀਂ ਆਪਣਾ ਸਹੀ ਰੱਖੀਏ